ਪੰਦਰਾਂ ਅਗਸਤ ਉੱਨੀ ਸੌ ਵੀਹ ਛੇ ਦਸੰਬਰ ਦੋ ਹਜ਼ਾਰ ਦੋ ਅੱਠ ਨਵੰਬਰ ਦੋ ਹਜ਼ਾਰ ਸੱਤ ਦਸ ਜਨਵਰੀ ਉੱਨੀ ਸੌ ਨੱਬੇ ਛੱਬੀ ਮਾਰਚ ਅਠਾਰ੍ਹਾਂ ਸੌ ਤੀਹ